ਸਮਾਜਿਕ ਅਤੇ ਆਰਥਿਕ ਸਸ਼ਕਤੀਕਰਨ ਉਤਸ਼ਾਹਿਤ ਕਰਨ ਵਿੱਚ ਕਲਾ ਅਤੇ ਸ਼ਿਲਪਕਾਰੀ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ ਖਾਸ ਕਰਕੇ ਪੰਜਾਬ ਵਿੱਚ ਇਸ ਦੀ ਇਹ ਬਹੁਤ ਵਧੀਆ ਭੂਮਿਕਾ ਨਿਭਾ ਰਿਹਾ ਹੈ ਅੱਜ ਦੇ ਸਮੇਂ ਵਿੱਚ ਕਲਾ ਅਤੇ ਸ਼ਿਲਪਕਾਰੀ ਦੀ ਬਹੁਤ ਜ਼ਿਆਦਾ ਡਿਮਾਂਡ ਹੋ ਰਹੀ ਹੈ ਮੈਂ ਮੈਂ ਸ਼ੁਰੂ ਤੋਂ ਹੀ ਡਰਾਇੰਗ ਦੇ ਵਿੱਚ ਚਿੱਤਰਕਾਰੀ ਦੇ ਵਿੱਚ ਦਿਲਚਸਪੀ ਰੱਖ ਰੱਖਦੀ ਆ ਰਹੀ ਹਾਂ ਇਸ ਲਈ ਮੈਂ ਸ਼ੁਰੂ ਤੋਂ ਹੀ ਤੋਂ ਜੋ ਵੀ ਮੈਨੂੰ ਚੀਜ਼ ਵਧੀਆ ਲੱਗਦੀ ਸੀ ਉਸ ਨੂੰ ਮੈਂ ਚਿੱਤਰਕਾਰੀ ਦੇ ਵਿੱਚ ਬਦਲ ਦਿੰਦੀ ਜਿਵੇਂ ਕਿ ਫੁੱਲ ਕੋਈ ਵੀ ਫੁੱਲ ਕੋਈ ਵੀ ਦਰੱਖਤ ਜਾਂ ਕੋਈ ਇਮਾਰਤ ਜੋ ਮੈਨੂੰ ਮਤਲਬ ਮੈਨੂੰ ਲੱਗਦਾ ਸੀ ਕਿ ਮੈਂ ਬਣਾ ਸਕਦੀ ਹਾਂ ਉਸ ਨੂੰ ਮੈਂ ਸ਼ ਸ਼ਿਲਪਕਾਰੀ ਦੀ ਰੂ ਦਾ ਰੂਪ ਦਿੱਤਾ ਮੈਂ ਆਪਣੇ ਇੱਕ ਦੋਸਤ ਦੇ ਦੇ ਹੱਥ ਉੱਤੇ ਇੱਕ ਟੈਟੂ ਬਣਾਇਆ ਜਿਸਦਾ ਮੈਂ ਪ ਜਿਸ ਦਾ ਰੇਟ ਮੈਂ ਪੰਦਰ੍ਹਾਂ ਹਜ਼ਾਰ ਤੱਕ ਰੱਖਿਆ ਜੋ ਕਿ ਜੋ ਕਿ ਮੈਂ ਉਸਨੂੰ ਜਦ ਬਣਾਇਆ ਤਾਂ ਉਹ ਇੰਨੇ ਵਧੀਆ ਤਰੀਕੇ ਨਾਲ ਬਣਿਆ ਸੀ ਕਿ ਉਹ ਮੈਨੂੰ ਪੰਜ ਹਜ਼ਾਰ ਤੋਂ ਅਲੱਗ ਰੁਪੀਜ ਰੁਪਏ ਦੇ ਕੇ ਗਿਆ ਇਸ ਲਈ ਫਿਰ ਮੈਨੂੰ ਲੱਗਿਆ ਕਿ ਮੈਨੂੰ ਆਪਣੀ ਕਲਾ ਨੂੰ ਹੋਰ ਜ਼ਿਆਦਾ ਹੋਰ ਜ਼ਿਆਦਾ ਉਤਸ਼ਾਹਿਤ ਕਰਨਾ ਚਾਹੀਦਾ ਹੈ ਇਸ ਲਈ ਇਹ ਮੈਂ ਸੋਚਿਆ ਕਿ ਮੇਰੀ ਕਲਾ ਇੱਕ ਆਰਥਿਕ ਰੂਪ ਆਰਥਿਕ ਰੂਪ ਨਾਲ ਮੇਰੀ ਮਦਦ ਕਰ ਸਕਦੀ ਹੈ ਇਸ ਲਈ ਮੈਂ ਇਸ ਲਈ ਕਲਾ ਅਤੇ ਸ਼ਿਲਪਕਾਰੀ ਮੇਰੇ ਜੀਵਨ ਵਿੱਚ ਬਹੁਤ ਵਧੀਆ ਭੂਮਿਕਾ ਨਿਭਾ ਰਹੀ ਹੈ ਜੋ ਕਿ ਮੈਂ ਇਸ ਨੂੰ ਅੱਗੇ ਤੱਕ ਲੈ ਕੇ ਜਾਵਾਂਗੀ